ਮੈਂ ਇੱਕ ਦਿਨ ਵਿੱਚ ਦੋ ਤੋਂ ਤਿੰਨ ਘੰਟੇ ਗਾਉਣ ਦਾ ਰਿਆਜ਼ ਕਰਦਾ ਹਾਂ ਅਤੇ ਗਾਉਣ ਲਈ ਸਮਾਂ ਸਮਰਪਿਤ ਕਰਦਾ ਹਾਂ ਮੈਂ ਗੀਤ ਸਿੱਖਣ ਲਈ ਦੋ ਸਾਜ਼ਾਂ ਦੀ ਵਰਤੋਂ ਕਰਦਾ ਹਾਂ ਜਿਹਨਾਂ ਦਾ ਨਾਮ ਹੈ ਹਰਮੋਨੀਅਮ ਅਤੇ ਗਿਟਾਰ ਮੈਂ ਭਿੰਨ ਭਿੰਨ ਤਰ੍ਹਾਂ ਦੇ ਗਾਣਿਆਂ ਵਿੱਚੋਂ ਵੱਖਰੀ ਵੱਖਰੀ ਧੁਨੀਆਂ ਨੂੰ ਸਮਝ ਕੇ ਉਹਨਾਂ ਨੂੰ ਅਲਾਪ ਦੇ ਰਾਹੀਂ ਗਾਉਂਦਾ ਹਾਂ ਅਤੇ ਜਿੱਥੇ ਜਿੱਥੇ ਕੋਈ ਗਲਤੀ ਹੁੰਦੀ ਹੈ ਉੱਥੇ ਆਪਣੇ ਉਸਤਾਦ ਜੀ ਕੋਲੋਂ ਸਿੱਖਿਆ ਲੈ ਕੇ ਉੱਥੇ ਉਸਨੂੰ ਸਹੀ ਕਰਦਾ ਹਾਂ ਇਹ ਸਭ ਤਰੀਕਿਆਂ ਨਾਲ ਹੀ ਮੈਂ ਗੀਤ ਸਿੱਖਦਾ ਹਾਂ